ਮੇਰੀ ਲਿਖਣ ਦੀ ਪ੍ਰਕਿਰਿਆ ਵਿੱਚ ਸਭ ਤੋਂ ਪਹਿਲਾਂ ਕੰਮ ਉਹ ਹੁੰਦਾ ਹੈ ਜਿਸ ਵਿੱਚ ਕਿ ਮੈਂ ਕਿਸੇ ਵੀ ਮੁੱਦੇ 'ਤੇ ਜਾਂ ਕਿਸੇ ਵੀ ਟੋਪਿਕ 'ਤੇ ਪ੍ਰਭਾਵਿਤ ਹੋ ਰਹੀ ਹਾਂ ਅਤੇ ਉਹ ਮੈਨੂੰ ਕਿਧਰੇ ਨਾ ਕਿਧਰੇ ਸੋਚਣ 'ਤੇ ਮਜਬੂਰ ਕਰ ਰਿਹਾ ਹੈ ਅਤੇ ਮੈਂ ਉਸ ਮੁੱਦੇ ਦੇ ਉੱਪਰ ਉਹ ਦੇ ਆਲੇ ਦੁਆਲੇ ਜੋ ਵੀ ਘਟਨਾਵਾਂ ਹੋਈਆਂ ਹੋਣ ਉਹਨਾਂ ਨੂੰ ਪਹਿਲਾਂ ਇੱਕ ਜਗ੍ਹਾ 'ਤੇ ਨੋਟ ਕਰ ਲੈਂਦੀ ਹਾਂ ਉਸ ਤੋਂ ਬਾਅਦ ਉਸ ਮੁੱਦੇ ਦੀ ਕੋਈ ਉਹ ਦਾ ਇਤਿਹਾਸਿਕ ਬੈਕਗਰਾਊਡ ਹੈ ਜਾਂ ਉਹ ਦਾ ਕੋਈ ਤਤਕਾਲਿਕ ਪ੍ਰਭਾਵ ਇਹੋ ਜਿਹਾ ਹੈ ਜਿਹੜਾ ਕਿ ਸਮਾਜ ਨੂੰ ਇਤਿਹਾਸਿਕ ਤੌਰ ਦੇ ਨਾਲ ਨਾਲ ਉਹ ਉਹਨਾਂ ਦੇ ਤਤਕਾਲੀਨ ਜੋ ਪਰਿਸਥਿਤੀਆਂ ਨੇ ਉਹਨਾਂ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ ਅਤੇ ਫਿਰ ਮੈਂ ਉਹ ਤਤਕਾਲੀਨ ਪਰਿਸਥਿਤੀਆਂ ਦਾ ਧਿਆਨ ਰੱਖਦੇ ਹੋਏ ਹੋਰ ਕੁਛ ਬਿੰਦੂ ਨੋਟ ਕਰ ਲੈਂਦੀ ਹਾਂ ਇਸ ਤਰ੍ਹਾਂ ਇੱਕ ਮੈਂ ਰੂਪ ਰੇਖਾ ਬਣਾ ਲੈਂਦੀ ਹਾਂ ਉਸ ਤੋਂ ਬਾਅਦ ਇੱਕ ਸੋਚਣ ਦਾ ਜਦੋਂ ਪ੍ਰਵਾਹ ਬਣ ਜਾਂਦਾ ਹੈ ਅਤੇ ਉਸ ਪ੍ਰਵਾਹ ਦੇ ਵਿੱਚ ਜੋ ਜੋ ਚੀਜ਼ਾਂ ਮੈਨੂੰ ਇਹ ਲੱਗਦੀਆਂ ਨੇ ਕਿ ਉਸ ਮੁੱਦੇ ਨਾਲ ਸਿੱਧੇ ਤੌਰ 'ਤੇ ਜੁੜੀਆਂ ਹੋਈਆਂ ਨੇ ਮੈਂ ਉਹਨਾਂ ਨੂੰ ਲਿਖ ਲੈਂਦੀ ਹਾਂ ਸਾਰੀਆਂ ਚੀਜ਼ਾਂ ਲਿਖਣ ਤੋਂ ਬਾਅਦ ਮੈਂ ਇਹ ਨਿਰਧਾਰਿਤ ਕਰਦੀ ਹਾਂ ਕਿ ਉਹ ਜੋ ਮੁੱਦੇ ਲਿਖੇ ਹੋਏ ਨੇ ਜਾਂ ਉਹਨਾਂ ਦੇ ਜਿਹੜੇ ਅੱਗੇ ਹੈਡਿੰਗਸ ਲਿਖੇ ਹੋਏ ਨੇ ਉਹਨਾਂ ਹੈਡਿੰਗਸ ਨੂੰ ਮੈਂ ਕਿਸ ਤਰ੍ਹਾਂ ਪਰਾਯੋਟੀ ਦੇ ਹਿਸਾਬ 'ਤੇ ਪ੍ਰਾਥਮਿਕਤਾ ਦੇ ਹਿਸਾਬ 'ਤੇ ਉਹਨਾਂ ਨੂੰ ਉੱਪਰ ਨੀਚੇ ਲਿਖ ਲੈਂਦੀ ਹਾਂ ਜਿਹੜਾ ਸਭ ਤੋਂ ਜ਼ਿਆਦਾ ਪ੍ਰਾਥਮਿਕ ਲੱਗਦਾ ਮੈਨੂੰ ਜਿਹੜਾ ਮੁੱਦਾ ਉਸ ਜਿਹੜੇ ਮੇਰੇ ਵਿਸ਼ਿਸ਼ਟ ਟੋਪਿਕ ਦੇ ਨਾਲ ਮਿਲਦਾ ਜੁਲਦਾ ਹੈ ਮੈਂ ਉਹਨੂੰ ਸਭ ਤੋਂ ਜ਼ਿਆਦਾ ਸਮੇਂ ਅਤੇ ਉਹਨੂੰ ਸਭ ਤੋਂ ਜ਼ਿਆਦਾ ਸੋਚਣ ਦਾ ਟਾਈਮ ਦਿੰਦੀ ਹਾਂ ਉਸ ਤੋਂ ਬਾਅਦ ਮੈਂ ਬਾਕੀ ਦੇ ਹੋਰ ਮੁੱਦੇ ਲਿਖ ਲੈਂਦੀ ਹਾਂ ਮੇਰੇ ਲਿਖਣ ਤੋਂ ਬਾਅਦ ਮੈਂ ਉਸ ਰੂਪ ਰੇਖਾ ਨੂੰ ਦੋ ਜਾਂ ਤਿੰਨ ਵਾਰ ਅੱਛੀ ਤਰੀਕੇ ਦੇ ਨਾਲ ਪੜ੍ਹਦੀ ਹਾਂ ਪੜ੍ਹ ਕੇ ਉਸ ਦੇ 'ਚ ਬਹੁਤ ਸਾਰੀਆਂ ਚੀਜ਼ਾਂ ਜੋ ਕਿ ਮੈਨੂੰ ਇਹ ਲੱਗਦੀਆਂ ਨੇ ਕਿ ਜ਼ਿਆਦਾ ਮਹੱਤਵਪੂਰਨ ਨਹੀਂ ਹੈਗੀਆਂ ਮੈਂ ਉਹਨਾਂ ਨੂੰ ਉਸ ਲਿਖਾਵਟ ਦੇ ਵਿੱਚੋਂ ਉਸ ਰੂਪ ਰੇਖਾ ਦੇ ਵਿੱਚੋਂ ਹਟਾ ਦਿੰਦੀ ਹਾਂ